ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਤੋਂ ਨਾ ਇੱਕ ਗੀਜ਼ਰ ਔਡਰ ਕੀਤਾ ਸੀ ਉਹ ਬਹੁਤ ਹੀ ਬੇਕਾਰ ਨਿਕਲਿਆ ਬਿਲਕੁਲ ਪਾਣੀ ਗਰਮ ਨਹੀਂ ਕਰਦਾ ਹੈ ਬਿਜਲੀ ਦਾ ਖ਼ਰਚਾ ਇੰਨਾਂ ਵੱਧ ਗਿਆ ਬਿਜਲੀ ਇੰਨੀ ਫੂਕਦਾ ਉਹ ਔਰ ਬਿਲਕੁਲ ਬੇਕਾਰ ਨਿਕਲਿਆ ਔਰ ਸਰਦੀਆਂ ਦੇ ਮੌਸਮ 'ਚ ਇੰਨਾਂ ਜ਼ਿਆਦਾ ਅ ਔਖੇ ਹੋਏ ਪਏ ਹੈ ਨਹਾਉਣੇ ਦੀ ਵੀ ਇੰਨੀ ਔਖੀ ਹੋਈ ਪਈ ਹੈ ਮੈਨੂੰ ਲੱਗਦਾ ਮੈਂ ਸਾਰੇ ਪੈਸੇ ਬਰਬਾਦ ਕਰ ਲਏ ਇੱਥੇ ਤੋਂ ਕਰਕੇ ਗੀਜ਼ਰ ਬਹੁਤ ਬੇਕਾਰ ਹੈ ਉਹ ਅੱਗੇ ਤੋਂ ਕਿਸੇ ਨੂੰ ਨਾ ਦਿਓ